ਮੈਂ ਦਸ ਦਿਨ ਪਹਿਲਾਂ ਫਲਿੱਪਕਾਰਟ 'ਤੇ ਆਪਣੇ ਹੈੱਡਫੋਨਸ ਦਾ ਔਡਰ ਦਿੱਤਾ ਸੀ ਜੋ ਮੈਨੂੰ ਕੱਲ੍ਹ ਰਸੀਵ ਹੋਏ ਅਤੇ ਇਹਨਾਂ ਦੀ ਪੈਕਜਿੰਗ ਦੇਖ ਕੇ ਬਹੁਤ ਮੇਰਾ ਮਨ ਖ਼ਰਾਬ ਹੋਇਆ ਜਦੋਂ ਮੈਂ ਇਸ ਨੂੰ ਓਪਨ ਕੀਤਾ ਅਤੇ ਹੈੱਡਫੋਨਸ ਦਾ ਕਲਰ ਚੇਂਜ ਸੀ ਜੋ ਮੈਨੇ ਵਾਈਟ ਔਡਰ ਕੀਤੇ ਸੀ ਉਹ ਬਲੈਕ ਮਿਲੇ ਉਸ ਤੋਂ ਬਾਅਦ ਮੈਨੇ ਇਸਨੂੰ ਫੋਨ ਨਾਲ ਕੋਨੈਕਟ ਕੀਤੇ ਤਾਂ ਇਹਨਾਂ ਦੀ ਅਵਾਜ਼ ਬਹੁਤ ਖ਼ਰਾਬ ਅਤੇ ਫਟੀ ਫਟੀ ਜਿਹੀ ਆ ਰਹੀ ਸੀ ਅਤੇ ਮੇਰਾ ਮਨ ਬਹੁਤ ਹੀ ਉਦਾਸ ਹੋ ਗਿਆ ਮੇਰੇ ਘਰਦੇ ਵੀ ਮੈਨੂੰ ਬੋਲੇ ਅਤੇ ਇਸਦੇ ਮੈਨੂੰ ਐਕਸਪੀਰੀਅੰਸ ਬਹੁਤ ਹੀ ਬੇਕਾਰ ਲੱਗਿਆ